ਜਿਵੇਂ ਕਿ ਪੇਂਟਿੰਗ ਵਾਲੀਆਂ ਚੀਜ਼ਾਂ ਬਣਾਉਣ ਵਿੱਚ ਆਹ ਹੱਥ ਵਾਲੀਆਂ ਚੀਜ਼ਾਂ ਬਣਾਉਣ ਵਾ ਬਣਾਉਣ ਵਿੱਚ ਤਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਿਵ ਕੰਮ ਵਿੱਚ ਮੈਂ ਬਹੁਤ ਬਿਜ਼ੀ ਰਹਿੰਦਾ ਹੈ ਜਿਵੇਂ ਕਿ ਮੈਨੂੰ ਤਾਂ ਲੋਹੇ ਦੀਆਂ ਚੀਜ਼ਾਂ ਬਹੁਤ ਬਣਾਉਣੀਆਂ ਆਉਂਦੀਆਂ ਨੇ ਮੈਂ ਲੋਹੇ ਦੀਆਂ ਚੀਜ਼ਾਂ ਦਾ ਬਹੁਤ ਬਣਾ ਕੇ ਦਿੱਤੀਆਂ ਨੇ ਪਰ ਮੈਨੂੰ ਹੱਥ ਨਾਲ ਪੇਂਟਿੰਗ ਨਾ ਤਾਂ ਮੈਨੂੰ ਮੇਰੀ ਪੇਂਟਿੰਗ ਵਧੀਆ ਹੈ ਅਤੇ ਨਾ ਹੀ ਮੈਨੂੰ ਅੱਛਾ ਲਿਖਣਾ ਆਉਂਦਾ ਹੈ ਇਸ ਕਰਕੇ ਮੈਂ ਕਿਸੇ ਨੂੰ ਬਣਾ ਕੇ ਨਹੀਂ ਦੇ ਸਕਦਾ ਨਾ ਮੇਰੇ ਕੋਲ ਕੋਈ ਟਾਈਮ ਹੈ ਵੀ ਮੈਨੂੰ ਇੰਨੇ ਘਰ ਦੇ ਕੰਮ ਹੁੰਦੇ ਨੇ ਕਿ ਮੇਰੇ ਕੋਲ ਕੋਈ ਟਾਈਮ ਨਹੀਂ ਹੁੰਦਾ